ਅੱਜ ਕੱਲ੍ਹ ਸਿਲਾਈ ਬਹੁਤ ਹੀ ਜ਼ਿਆਦਾ ਕੀਤੀ ਜਾ ਰਹੀ ਹੈ ਸਾਰਿਆਂ ਨੂੰ ਵੰਨ ਸੁਵੰਨੇ ਵਾਲੇ ਸੂਟ ਪਾਉਣ ਦੀ ਦਿਲ ਦਿਲਚਸਪੀ ਲੱਗੀ ਰਹਿੰਦੀ ਹੈ ਅਲੱਗ ਅਲੱਗ ਤਰੀਕੇ ਦੇ ਕੱਪੜੇ ਪਾਉਂਦੇ ਹਨ ਪੈਂਟ ਪਲਾਜੋ ਫਲੇਅਰ ਸਲਵਾਰ ਪਟਿਆਲਾ ਸਲਵਾਰ ਧੋਤੀ ਸਲਵਾਰ ਅਨਾਰਕਲੀ ਕਮੀਜ਼ ਕੁਰਤਾ ਆਦਿ ਸਭ ਲੋਕ ਪਾਉਂਦੇ ਹਨ ਇਹਨਾਂ ਨੂੰ ਸੀਨ ਦਾ ਵੱਖ ਵੱਖ ਤਰੀਕਾ ਹੈ ਅਤੇ ਇਹ ਬੜੇ ਹੀ ਆਸਾਨੀ ਨਾਲ ਸੀਤੇ ਜਾ ਸਕਦੇ ਹਨ ਪਹਿਲਾਂ ਕੱਪੜੇ ਨੂੰ ਚੰਗੀ ਤਰ੍ਹਾਂ ਨਾਲ ਕੱਟ ਕੇ ਫਿਰ ਉਸਨੂੰ ਵਧੀਆ ਤਰੀਕੇ ਨਾਲ ਸੀਨ ਦਾ ਨਵੇਂ ਨਵੇਂ ਡਿਜ਼ਾਇਨ ਪਾ ਕੇ ਸੀਨ ਸੀਤੇ ਜਾਂਦੇ ਹਨ ਅਤੇ ਇਹ ਸੀਨ ਵਿੱਚ ਬੜੇ ਹੀ ਮਜ਼ੇਦਾਰ ਅਤੇ ਸਰਲ ਤਰੀਕੇ ਨਾਲ ਸੀਤੇ ਜਾ ਸਕਦੇ ਹਨ ਚੰਗੇ ਤਰੀਕੇ ਨਾਲ ਸੀਨ ਲਈ ਅਸਾਂ ਨੂੰ ਸਹੀ ਢੰਗ ਨਾਲ ਬੈਠ ਕੇ ਤਰੀਕੇ ਨਾਲ ਮਸ਼ੀਨ ਚਲਾਉਣੀ ਚਾਹੀਦੀ ਹੈ ਅਤੇ ਇਹਨਾਂ ਨੂੰ ਸੀਨ ਦੀ ਪਰੰਪਰਾ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ ਅਸੀਂ ਬੜੇ ਹੀ ਸਰਲ ਤਰੀਕੇ ਨਾਲ ਕੱਪੜਿਆਂ ਨੂੰ ਸੀ ਸਕਦੇ ਹਾਂ ਹੱਥਾਂ ਨਾਲ ਇਹਨਾਂ ਦੀ ਲੋਨ ਸੀ ਕੇ ਫਿਰ ਇਹਨਾਂ ਨੂੰ ਮਸ਼ੀਨ ਉੱਤੇ ਧਰ ਕੇ ਵਧੀਆ ਤਰੀਕੇ ਨਾਲ ਬੁਕਰਮ 'ਤੇ ਡਿਜ਼ਾਇਨ ਪਾ ਕੇ ਕੱਪੜੇ ਉੱਤੇ ਸਟਿਚ ਕਰਕੇ ਅਤੇ ਡਿਜ਼ਾਇਨ ਬਣਾ ਸਕਦੇ ਹਾਂ ਕੋਈ ਵੀ ਐਸਾ ਕੰਮ ਨਹੀਂ ਹੈ ਜੋ ਨਹੀਂ ਕਰ ਸਕਦੇ ਕੋਈ ਵੀ ਐਸਾ ਡਿਜ਼ਾਇਨ ਨਹੀਂ ਹੈ ਜੋ ਅਸੀਂ ਕੱਪੜੇ ਉੱਤੇ ਨਹੀਂ ਪਾ ਸਕਦੇ ਅਸੀਂ ਕੱਪੜੇ ਉੱਤੇ ਵਧੀਆ ਤਰੀਕੇ ਨਾਲ ਵਧੀਆ ਢੰਗ ਨਾਲ ਚੰਗੇ ਚੰਗੇ ਸੋਹਣੇ ਸੋਹਣੇ ਡਿਜ਼ਾਇਨ ਪਾ ਸਕਦੇ ਹਾਂ ਰੰਗਦਾਰ ਡਿਜ਼ਾਇਨ ਵੱਖਰੇ ਵੱਖਰੇ ਡਿਜ਼ਾਇਨ ਵੱਖਰੀਆਂ ਵੱਖਰੀਆਂ ਵੰਨ ਸਵੰਨੀਆਂ ਬਾਹਵਾਂ ਉੱਤੇ ਡਿਜ਼ਾਇਨ ਪੋਂਚਿਆਂ 'ਤੇ ਡਿਜ਼ਾਇਨ ਬੜੇ ਹੀ ਤਰੀਕਿਆਂ ਨਾਲ ਕੱਪੜੇ ਡਿਜ਼ਾਇਨਰ ਬਣਾ ਸਕਦੇ ਹਾਂ ਸਿੰਪਲ ਅਤੇ ਸਿੰਪਲ ਸੂਟ ਨੂੰ ਲੈ ਕੇ ਅਸੀਂ ਚੰਗੀ ਤਰ੍ਹਾਂ ਡਿਜ਼ਾਇਨ ਕਰ ਸਕਦੇ ਹਾਂ